ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਤੁਸੀਂ ਸਵੀਗੀ ਓਰਡਰ ਬੁਆਏ ਬੋਲ ਰਹੇ ਹੋ ਨਾ ਹਾਂਜੀ ਹਾਂਜੀ ਮੈਂ ਨਾ ਐਕਚੂਲੀ ਆਪਣਾ ਇੱਕ ਓਰਡਰ ਪਲੇਸ ਕੀਤਾ ਸੀਗਾ ਜਿਹਦੇ ਵਿੱਚ ਮੈਂ ਇੱਕ ਕੋਲਡ ਡਰਿੰਕ ਬਰਗਰ ਪਾਸਤਾ ਔਰ ਨਿਊਡਲਸ ਕੀਤੇ ਸੀਗੇ ਓਰਡਰ ਅਤੇ ਮੇਰੇ ਘਰ ਨਾ ਹੁਣ ਭਾਅ ਜੀ ਬਹੁਤ ਸਾਰੇ ਰਿਸ਼ਤੇਦਾਰ ਆਏ ਹੋਏ ਆ ਅਤੇ ਮੈਂ ਹੁਣ ਕਦੋਂ ਦੀ ਵੇਟ ਕਰ ਰਹੀ ਹਾਂ ਐਕਚੂਲੀ ਹੁਣ ਮੈਨੂੰ ਲੱਗਦਾ ਵੀਹ ਮਿੰਟ ਤੋਂ ਉੱਤੇ ਹੋ ਗਿਆ ਅਤੇ ਮੈਂ ਕਦੋਂ ਦਾ ਵੇਟ ਕਰ ਰਹੀ ਹਾਂ ਕਿ ਤੁਸੀਂ ਜਦ ਆਓਗੇ ਤਾਂ ਮੈਂ ਐਟਲਿਸਟ ਮੈਂ ਆਪਣੇ ਜਿਹੜੇ ਗੈਸਟ ਆ ਉਹਨਾਂ ਨੂੰ ਦੇਖ ਲਵਾਂ ਅਤੇ ਤੁਸੀਂ ਹੁਣ ਕਿੱਥੇ ਹੋ ਇਸ ਟਾਈਮ ਵੈਸੇ ਓਕੇ ਤੁਸੀਂ ਹੁਣ ਦੂਜਾ ਆਪਣਾ ਮੈਨੂੰ ਲੱਗਦਾ ਕਿਸੇ ਹੋਰ ਦਾ ਪਾਰਸਲ ਦੇ ਰਹੇ ਹੋਂਗੇ ਪਲੀਸ ਤੁਸੀਂ ਮੈਨੂੰ ਜਿੰਨਾਂ ਜਲਦੀ ਹੋ ਸਕੇ ਨਾ ਮੈਨੂੰ ਦੱਸ ਦਿਉ ਵੀ ਕਿੰਨੇ ਟਾਈਮ ਤੱਕ ਤੁਸੀਂ ਆਓਗੇ ਕਿਉਂਕਿ ਹੁਣ ਵੀਹ ਮਿੰਟ ਤੋਂ ਉੱਤੇ ਹੋ ਗਿਆ ਔਰ ਮੇਰੇ ਗੈਸਟ ਵੀ ਵੇਟ ਕਰ ਰਹੇ ਆ ਈਵਨ ਮੈਨੂੰ ਖੁਦ ਨੂੰ ਭੁੱਖ ਲੱਗੀ ਹੋਈ ਹੈ ਮੈਨੂੰ ਲੱਗਦਾ ਅੱਜ ਪਹਿਲੀ ਵਾਰ ਹੋਇਆ ਹੈ ਕਿ ਇੰਨਾਂ ਟਾਈਮ ਲੱਗ ਰਿਹਾ ਡਿਲਵਰੀ ਨੂੰ ਅਦਰਵਾਈਸ ਇੱਦਾਂ ਨਹੀਂ ਹੁੰਦਾ ਸੀਗਾ ਪਹਿਲਾਂ ਕਿਰਪਾ ਕਰਕੇ ਤੁਸੀਂ ਮੈਨੂੰ ਨਾ ਮੈਂ ਰਿਕੁਏਸਟ ਏ ਕਰ ਰਹੀ ਆ ਕਿ ਤੁਸੀਂ ਪਲੀਸ ਜਲਦੀ ਤੋਂ ਜਲਦੀ ਮੇਰਾ ਨਾ ਜਿਹੜਾ ਪਾਰਸਲ ਹੈ ਉਹ ਮੇਰੇ ਤੱਕ ਪੁੱਜਦਾ ਕਰ ਦਿਉ